ਭਾਰਤੀ ਸੰਸਕ੍ਰਿਤੀ ਵਿੱਚ ਰਵਾਇਤੀ ਨਾਚਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਭਾਰਤ ਵਿੱਚ ਕਈ ਤਰ੍ਹਾਂ ਦੇ ਵਿਭਿੰਨ ਵਿਭਿੰਨ ਖੇਤਰਾਂ ਵਿੱਚ ਵਿਭਿੰਨ ਵਿਭਿੰਨ ਖੇਤਰਾਂ ਵਿੱਚ ਵਿਭਿੰਨ ਵਿਭਿੰਨ ਰਾਜਾਂ ਵਿੱਚ ਆਪਣੇ ਆਪਣੇ ਖੇਤਰ ਮੁਤਾਬਿਕ ਨਾਚ ਕਈ ਤਰ੍ਹਾਂ ਦੇ ਨਾਚ ਕਰਵਾਏ ਜਾਂਦੇ ਹਨ ਜਿਵੇਂ ਕਿ ਕੱਥਕ ਡਾਂਡੀਆਂ ਭੰਗੜਾ ਗਿੱਧਾ ਆਦਿ ਠੀਕ ਆ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਜ਼ਿਆਦਾਤਰ ਭੰਗੜਾ ਪਾਇਆ ਜਾਂਦਾ ਹੈ ਠੀਕ ਆ ਪੰਜਾਬ ਵਿੱਚ ਭੰਗੜਾ ਪਾਇਆ ਜਾਂਦਾ ਭੰਗੜਾ ਹਮੇਸ਼ਾਂ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਦੋਂ ਵੀ ਕਦੇ ਵੀ ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਪੰਜਾਬ ਵਿੱਚ ਉਸਨੂੰ ਭੰਗੜੇ ਨਾਲ ਜ਼ਾਹਰ ਕੀਤਾ ਜਾਂਦਾ ਹੈ ਠੀਕ ਆ ਭੰਗੜਾ ਪਾਉਣ ਲਈ ਇੱਕ ਡਾਂਸਰ ਨੇ ਭੰਗੜਾ ਪਾਉਣ ਲਈ ਇੱਕ ਡਾਂਸਰ ਲਈ ਉਹਦੇ 'ਚ ਬਹੁਤ ਤਰ੍ਹਾਂ ਦੀਆਂ ਕੁਆਲਟੀਆਂ ਹੋਣੀਆਂ ਚਾਹੀਦੀਆਂ ਹਨ ਜਿਸ ਕਾਰਨ ਭੰਗੜਾ ਪੈਂਦਾ ਹੈ ਜਿਵੇਂ ਕਿ ਉਹ ਬੰਦਾ ਪੂਰੀ ਤਰ੍ਹਾਂ ਸੰਤੁਸ਼ਟ ਹੋਣਾ ਚਾਹੀਦਾ ਹੈ ਪਰਫੈਕਟ ਹੋਣਾ ਚਾਹੀਦਾ ਹੈ ਠੀਕ ਹੈ ਉਸਦਾ ਕੋਈ ਅੰਗ ਹੀਣ ਨਹੀਂ ਹੋਣਾ ਚਾਹੀਦਾ ਠੀਕ ਹੈ ਅਤੇ ਜਿਹੜੀ ਉਸਦੀ ਕਪੈਸ਼ਟੀ ਹੈ ਉਹ ਸ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਜਿਹੜਾ ਉਹਦੇ ਸਰੀਰ ਦੀ ਲਚਕ ਆ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ਼ ਹੋਣੀ ਚਾਹੀਦੀ ਆ ਤਾਂ ਜੋ ਉਹ ਆਪਣੇ ਸਰੀਰ ਨੂੰ ਉਸ ਉਸ ਨਾਚ ਮੁਤਾਬਿਕ ਢਾਲ ਸਕੇ ਠੀਕ ਹੈ